ਮੇਰੇ ਪੇਸ਼ੇ ਨੂੰ ਛੱਡ ਕੇ ਮੇਰੇ ਜਿਹੜੇ ਸ਼ੌਕ ਜਾਂ ਰੁੱਚੀਆਂ ਹਨ ਉਹ ਇੱਕ ਵੈੱਬ ਡਿਵਲੈਪਮੈਂਟ ਦੇ ਵਿੱਚ ਹੈ ਅਤੇ ਦੂਜੀ ਮੇਰੀ ਇੱਕ ਐਥੀਕਲ ਹੈਕਿੰਗ ਦੇ ਵਿੱਚ ਹੈ ਵੈੱਬ ਡਿਪੇਲਪਮੈਂਟ ਦੇ ਵਿੱਚ ਅਸੀਂ ਵੈੱਬਸਾਈਟ ਬਣਾਉਂਦੇ ਹਾਂ ਜਿਹਦੇ ਵਿੱਚ ਇੱਕ ਬੈਂਕਐਂਡ ਫਰੰਟਐਂਡ ਹੁੰਦਾ ਹੈ ਫਰੰਟਐਂਡ ਦੇ ਵਿੱਚ ਜਿਹੜਾ ਕਿ ਸਾਨੂੰ ਸਕਰੀਨ ਦੇ ਉੱਤੇ ਦਿਖਾਈ ਦੇਣ ਵਾਲਾ ਜਿੰਨਾ ਵੀ ਅ ਡਿਸਪਲੇਅ ਹੈ ਉਹ ਸਾਨੂੰ ਦਿਖਦਾ ਹੈ ਅਤੇ ਬੈਂਕਐਂਡ ਦੇ ਵਿੱਚ ਜਿਹੜੇ ਪਿੱਛੇ ਜਿਹੜੇ ਪ੍ਰੋਸੈਸ ਚੱਲ ਰਹੇ ਹਨ ਉਹ ਹੁੰਦੇ ਹਨ ਫਿਲਹਾਲ ਮੈਂ ਇੱਕ ਵੈੱਬਸਾਈਟ ਦੇ ਉੱਤੇ ਕੰਮ ਕਰ ਰਿਹਾ ਹਾਂ ਜਿਹੜਾ ਕਿ ਸਰਕਾਰੀ ਜਿਹੜੇ ਕਾਗਜ਼ ਨੇ ਜਾਂ ਫਿਰ ਜਿਹੜੇ ਫੌਮਸ ਨੇ ਜਿਹੜੀ ਲੀਵਸ ਨੇ ਇਹਨਾਂ ਦਾ ਜਿਹੜਾ ਫਲੋ ਹੈ ਕਿ ਛੋਟੇ ਪੱਧਰ ਤੋਂ ਉਸ ਤੋਂ ਬਾਅਦ ਵੱਡੇ ਅਫ਼ਸਰਾਂ ਕੋਲ ਜਿਹੜੀ ਇਹ ਕਾਗਜ਼ ਜਾਂਦਾ ਹੈ ਤਾਂ ਇਹਨੂੰ ਅਸੀਂ ਡਿਜ਼ੀਟ ਜੀ ਡਿਜੀਟਲਾਈਸਡ ਕਿਵੇਂ ਕਰ ਦਵਾਂਗੇ ਅਤੇ ਦੂਜਾ ਸ਼ੌਕ ਹੈ ਜਿਹੜਾ ਮੇਰਾ ਐਥੀਕਲ ਹੈਕਿੰਗ ਦਾ ਉਹਦੇ ਵਿੱਚ ਅਸੀਂ ਹੈਕ ਮੈਂ ਐਖੇ ਹੈਕਿੰਗ ਸਿੱਖ ਰਿਹਾ ਫੌਰ ਸਿਕਿਉਰਟੀ ਪਰਪਸ